ਮੈਂ ਆਪਣਾ ਗੈ ਗੈਸ ਸਿਲੰਡਰ ਦੀ ਬੁਕਿੰਗ ਕੀਤੀ ਸੀ ਜਿਸ ਦੀ ਮਿਤੀ ਸੀ ਪਹੁੰਚਾਉਣ ਦੀ ਪੰਦਰ੍ਹਾਂ ਨਵੰਬਰ ਪਰ ਇਹ ਸਪੁਰਦਗੀ ਮਿਤੀ ਨੂੰ ਪਾਰ ਕਰ ਗਿਆ ਹੈ ਮੇਰੀ ਬੁਕਿੰਗ ਸੰਦਰਭ ਨੰਬਰ ਹੈ ਨੌਂ ਅੱਠ ਸੱਤ ਛੇ ਪੰਜ ਚਾਰ ਪਲੀਸ ਮੇਰਾ ਇਹ ਬੁਕਿੰਗ ਨੰਬਰ ਦੇਖ ਕੇ ਮੈਨੂੰ ਜਲਦੀ ਤੋਂ ਜਲਦੀ ਮੇਰਾ ਸਿਲੰਡਰ ਪਹੁੰਚਾਇਆ ਜਾਵੇ ਮੈਂ ਤੁਹਾਡੇ ਤੋਂ ਤੁਰੰਤ ਸਹਾਇਤਾ ਲਈ ਬੇਨਤੀ ਕਰਦੀ ਹਾਂ ਕਿਉਂਕੀ ਮੈਨੂੰ ਸਿਲੰਡਰ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸਾਡੇ ਘਰ ਵਿੱਚ ਖਾਣਾ ਨਹੀਂ ਬਣ ਰਿਹਾ ਸਿਲੰਡਰ ਕਰਕੇ ਇਸ ਕਰਕੇ ਪਲੀਸ ਮੈਨੂੰ ਸ ਸਿਲੰਡਰ ਜਲਦੀ ਤੋਂ ਜਲਦੀ ਪਹੁੰਚਾਇਆ ਜਾਵੇ ਆਪ ਜੀ ਦੀ ਬਹੁਤ ਬਹੁਤ ਧੰਨਵਾਦੀ ਹੋਵਾਂਗੀ